ਮੈਂ ਛੋਟੀ ਉਮਰ ਵਿੱਚ ਆਪਣੀ ਵੱਡੀ ਭੈਣ ਨੂੰ ਸਿਲਾਈ ਕਰਦੇ ਵੇਖਦੀ ਅਤੇ ਮੇਰਾ ਬੜਾ ਜੀ ਕਰਦਾ ਕਿ ਮੈਂ ਵੀ ਇੱਦਾਂ ਹੀ ਸਿਲਾਈ ਕਰਾਂ ਅਤੇ ਮੈਂ ਆਪਣੀ ਦੀਦੀ ਨੂੰ ਕਿਹਾ ਕਿ ਦੀਦੀ ਮੈਂ ਵੀ ਸਿਲਾਈ ਸਿੱਖਣੀ ਹੈ ਅਤੇ ਮੈਨੂੰ ਸਿਲਾਈ ਸਿੱਖਣ ਦਾ ਮੌਕਾ ਮਿਲਿਆ ਅਤੇ ਫਿਰ ਮੈਂ ਤੋਂ ਨਵੇਂ ਨਵੇਂ ਡਿਜ਼ਾਇਨ ਸਿੱਖੇ ਅਤੇ ਹੁਣ ਮੈਂ ਆਪਣੇ ਅਤੇ ਆਪਣੀ ਬੇਟੀ ਦੇ ਸੂਟ ਖੁਦ ਸਿਲਾਈ ਕਰਦੀ ਹਾਂ ਇਸ ਨਾਲ ਹੀ ਆਪਣੇ ਸੂਟਾਂ ਦੀ ਸਿਲਾਈ ਦਾ ਖਰਚਾ ਬਚਾਉਂਦੀ ਹਾਂ ਅਤੇ ਲੋਕਾਂ ਦੇ ਸੂਟਾਂ ਦੀ ਸਿਲਾਈ ਕਰਕੇ ਆਪਣੀ ਅਲੱਗ ਤੋਂ ਜੇਬ ਖਰਚ ਵੀ ਬਣਾਉਂਦੀ ਹਾਂ ਅਤੇ ਮੈਂ ਦੂਜਿਆਂ ਨੂੰ ਵੀ ਪ੍ਰੇਰਨਾ ਦਿੰਦੀ ਹਾਂ ਕਿ ਤੁਸੀਂ ਵੀ ਸਿਲਾਈ ਕਰਨਾ ਸਿੱਖ ਲਵੋ ਤਾਂ ਜੋ ਆਪਣੇ ਸੂਟਾਂ ਦੀ ਸਿਲਾਈ ਦੇਣ ਤੋਂ ਤਾਂ ਬਚੋਗੇ ਅਤੇ ਨਾਲ ਹੀ ਦੂਜਿਆਂ ਦੇ ਸੂਟ ਸਿਓਂ ਕੇ ਪੈਸੇ ਕਮਾਉਣ ਲੱਗੋਗੇ ਤਾਂ ਜੋ ਆਪਣੇ ਘਰ ਦੇ ਖਰਚ ਵਿੱਚ ਮਦਦ ਕੀਤੀ ਜਾ ਸਕੇ